ਸਤਿ ਸ਼੍ਰੀ ਅਕਾਲ ਜੀ ਮੈਂ ਮੀਡੀਆ ਰਿਪੋ ਮੈਂ ਮੀਡੀਆ ਰਿਪੋਰਟ ਬੋਲ ਰਹੀ ਹਾਂ ਅਤੇ ਮੈਂ ਪੁੱਛਣਾ ਹੁਸ਼ਿਆਰਪੁਰ ਦੇ ਵਿੱਚ ਰੋਡ ਪਾਣੀ ਬਿਜਲੀ ਇਹ ਸਭ ਕਿਸ ਤਰ੍ਹਾਂ ਹੈ ਹਾਂਜੀ ਵਿਕਾਸ ਕਿਸ ਤਰ੍ਹਾਂ ਹੋਇਆ ਇਹਨਾਂ ਚੀਜ਼ਾਂ ਦਾ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਅਤੇ ਹੁਸ਼ਿਆਰਪੁਰ ਦੇ ਵਿੱਚ ਕੀ ਬਿਜਲੀ ਚੌਵੀ ਘੰਟੇ ਆ ਰਹੀ ਆ ਕਿਸੇ ਨੂੰ ਬਿਜਲੀ ਲਈ ਕੋਈ ਦਿੱਕਤ ਤਾਂ ਨਹੀਂ ਹੋ ਰਹੀ ਅੱਛਾ ਜੀ ਅਤੇ ਜੋ ਮਤਲਬ ਕਿ ਬਿਜਲੀ ਦੇ ਬਿਲ ਆ ਰਹੇ ਨੇ ਕੀ ਬਿਲ ਜ਼ਿਆਦਾ ਆ ਰਹੇ ਆ ਜਾਂ ਲੋਕਾਂ ਨੂੰ ਹੋ ਰਿਹਾ ਆ ਕੀ ਬਿੱਲ ਜੀਰੋ ਆ ਰਿਹਾ

ਠੀਕ ਆ ਜੀ ਜੇ ਤੁਸੀਂ ਮੈਂ ਤੁਹਾਡਾ ਪਰਸਨਲ ਓਪੀਨੀਅਨ ਲੈਣਾ ਚਾਹਵਾਂ ਤਾਂ ਕੀ ਤੁਸੀਂ ਸਰਕਾਰ ਦੀਆਂ ਜੋ ਵੀ ਸਰਕਾਰ ਸੁਵਿਧਾਵਾਂ ਦੇ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਤਾਂ ਕੀ ਤੁਸੀਂ ਉਹਦੇ ਨਾਲ ਸੰਤੁਸ਼ਟ ਹੋ ਕੀ ਤੁਸੀਂ ਸੰਤੁ ਠੀਕ ਹੈ ਠੀਕ ਹੈ ਤੁਹਾਡਾ ਹਾਂਜੀ ਠੀਕ ਆ ਜੀ ਅੱਛਾ ਜੀ ਤੁਹਾਡਾ ਸੁਝਾਅ ਸੁਝਾਅ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ